ਹੈਲੋ ਸਤਿ ਸ਼੍ਰੀ ਅਕਾਲ ਜਸਵੀਰ ਮੈਂ ਨਾ ਐਕਚੂਅਲੀ ਨਵੀਂ ਆਈ ਸੀ ਤਾਂ ਮੈਨੂੰ ਫਰੈੱਸ਼ ਵੈਜੀਟੇਬਲਸ ਲੈਣੇ ਸੀ ਤਾਂ ਮੈਨੂੰ ਕੁਛ ਵੀ ਪਤਾ ਨਹੀਂ ਲੱਗ ਰਿਹਾ ਹਾਂਜੀ ਮੇਰੀ ਮਦਰ ਇਨ ਲੋ ਨੇ ਮੈਨੂੰ ਤੁਹਾਡਾ ਨੰਬਰ ਦਿਆ ਸੀ ਹਾਂਜੀ ਹਾਂਜੀ ਹਾਂਜੀ ਮੈਂ ਅੱਠ ਫੇਸ ਰਹਿੰਦੀ ਹਾਂ ਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਹਾਂਜੀ ਠੀਕ ਹੈ ਜੀ ਨਹੀ ਹੁਣ ਤਾਂ ਵੈਸੇ ਹੈ ਨਹੀਂ ਅਗਰ ਕੋਈ ਹੋਈ ਪ੍ਰੋਬਲਮ ਤਾਂ ਮੈਂ ਤੁਹਾਨੂੰ ਫੇਰ ਕੋਲ ਕਰਦਾਂਗੀ ਹਾਂਜੀ ਠੀਕ ਹੈ ਸਤਿ ਸ਼੍ਰੀ ਅਕਾਲ ਜੀ